ਸਾਡੇ ਇਲਾਕੇ ਕਪੂਰਥਲੇ ਦੇ ਵਿੱਚ ਕਾਫ਼ੀ ਇਤਿਹਾਸਿਕ ਇਮਾਰਤਾਂ ਹਨ ਜਿੰਨ੍ਹਾਂ ਵਿੱਚ ਇੱਕ ਇੱਕ ਦਾ ਨਾਮ ਜਗਜੀਤ ਪੈਲਸ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਕ ਨੇ ਬਣਾਇਆ ਸੀ ਜੋ ਕਿ ਕਾਫ਼ੀ ਦਿਖਣ ਨੂੰ ਕਾਫ਼ੀ ਸੁੰਦਰ ਹੈ ਅਤੇ ਸਾਡੇ ਇਲਾਕੇ ਵਿੱਚ ਇ ਇੱਕ ਕਾਂਜਲੀ ਵੈਟਲੈਂਡ ਹੈ ਜਿਹੜਾ ਦੇਖਣ ਨੂੰ ਵੀ ਕਾਫ਼ੀ ਸੋਹਣਾ ਹੈ ਵੈਟਲੈਂਡ ਉਹ ਥਾਂ ਹੁੰਦੀ ਹੈ ਜਿੱਥੇ ਜਿੱਥੇ ਦੀ ਭੂਮੀ ਦਲਦਲ ਦਲਦਲੀ ਹੁੰਦੀ ਹੈ ਅਤੇ ਸਾਡੇ ਇਲਾਕੇ ਵਿੱਚ ਇੱਕ ਸ਼ਾਲੀਮਾਰ ਗਾਰਡਨ ਵੀ ਹੈ ਜਿ ਜਿੱਥੇ ਬਹੁਤ ਸਾਰੇ ਫੁੱਲ ਲੱਗੇ ਹੋਏ ਹੈ ਜਿੱਥੇ ਦੂਰ ਦੂਰ ਤੋਂ ਲੋਕ ਵਿਦੇਸ਼ ਤੋਂ ਸ਼ਾਲੀਮਾਰ ਗਾਰਡਨ ਜਗਜੀਤ ਪੈਲਸ ਅਤੇ ਕਾਂਜਲੀ ਵੈਟਲੈਂਡ ਨੂੰ ਦੇਖਣ ਲਈ ਆਉਂਦੇ ਹਨ ਅਤੇ ਸਾਡੇ ਇਲਾਕੇ ਵਿੱਚ ਔਰ ਵੀ ਬਥੇਰੇ ਕੁਛ ਦੇਖਣ ਲਾਇਕ ਹੈ